ਸਾਡੇ ਸਮਾਜ ਵਿੱਚ ਆਮ ਤੌਰ 'ਤੇ ਕਲਾ ਨੂੰ ਬਹੁਤ ਹੀ ਮਤਲਬ ਹੁਣ ਬਹੁ ਬਹੁਤ ਹੀ ਬਹੁਤ ਮਸ਼ਹੂਰ ਸਮਝਿਆ ਜਾਂਦਾ ਭਾਵ ਉਹਨੂੰ ਕਲਾ ਨੂੰ ਹੀ ਮਹੱਤਵਪੂਰਨ ਸਮਝਿਆ ਜਾਂਦਾ ਹੈ ਇੱਕ ਜੋ ਕਿ ਸਾਡੇ ਸਮਾਜ ਵਿੱਚ ਹਰੇਕ ਵਿਅਕਤੀ ਵਿੱਚ ਕੋਈ ਨਾ ਕੋਈ ਕਲਾ ਹੁੰਦੀ ਹੈ ਜਿਵੇਂ ਕਿ ਡਾਂਸ ਮਿਊਜ਼ਿਕ ਪੇਂਟਿੰਗ ਡਿਜ਼ਾਇਨਰ ਹਰੇਕ ਤਰ੍ਹਾਂ ਦੀ ਅਲੱਗ ਅਲੱਗ ਕਲਾਵਾਂ ਕਲਾ ਕੀਤੀਆਂ ਜਾਂਦੀਆਂ ਹਨ ਹਰੇਕ ਰਾਜ ਵਿੱਚ ਸੱਭਿਆਚਾਰ ਨਾਲ ਪਛਾਣ ਉਸ ਵਿਅਕਤੀ ਨੂੰ ਕੀਤੀ ਜਾਂਦੀ ਹੈ ਕਿਉਂਕਿ ਜਿਹੜੇ ਵਿਅਕਤੀ ਵਿੱਚ ਸ਼ਿਲਪਕਾਰੀ ਉਹ ਹੱਥੀਂ ਕੰਮ ਕਰਨ ਦੀ ਭਾਵਨਾ ਹੋਵੇ ਉਸ ਨੂੰ ਹ ਉਸ ਨੂੰ ਮਹੱਤਵਪੂਰਨ ਦੇ ਦੇਣ ਦਿੱਤੀ ਜਾਂਦੀ ਹੈ ਜੋ ਕਿ ਮਤਲਬ ਹੱਥੀਂ ਕੰਮ ਕਰਦਾ ਤਾਂ ਉਸਨੂੰ ਉਸ ਤਰ੍ਹਾਂ ਉਸਦੇ ਲੈਵਲ ਦਾ ਹੀ ਕੰਮ ਦਿੱਤਾ ਜਾਂਦਾ ਹੈ ਇਸ ਲਈ ਸਾਡੇ ਸਮਾਜ ਵਿੱਚ ਸ਼ਿਲਪਕਾਰੀ ਅਤੇ ਕਲਾਵਾਂ ਲੋਕ ਖੇਤਰ ਕਲਾਵਾਂ ਵਿੱਚ ਆਮ ਤੌਰ 'ਤੇ ਉਹਨਾਂ ਨੂੰ ਮਹੱਤਵਪੂਰਨ ਸਮਝੀ ਜਾਂਦੀ ਹੈ